ਸਤਿ ਸ਼੍ਰੀ ਅਕਾਲ ਜੀ ਤੁਸੀਂ ਐਮਾਜ਼ੋਨ ਤੋਂ ਬੋਲ ਰਹੇ ਹੋ ਮੈਂ ਪੰਦਰਾਂ ਕੁ ਦਿਨ ਪਹਿਲਾਂ ਐਮਾਜ਼ੋਨ ਤੋਂ ਕਿਤਾਬਾਂ ਓਰਡਰ ਕੀਤੀਆਂ ਸਨ ਜਿਨ੍ਹਾਂ ਦੀ ਪੈਕੇਜਿੰਗ ਵੀ ਖਰਾਬ ਨਿਕਲੀ ਜਿਨ੍ਹਾਂ ਦੀ ਪੇਜ ਕੁਆਲਿਟੀ ਵੀ ਖਰਾਬ ਨਿਕਲੀ ਅਤੇ ਕਿਤਾਬਾਂ ਪੂਰੀਆਂ ਵੀ ਨਹੀਂ ਆਈਆਂ ਮੈਨੂੰ ਤਾਂ ਮੈਨੂੰ ਅੱਜ ਪਤਾ ਲੱਗਿਆ ਹੈ ਕਿ ਉਹ ਕਿਤਾਬਾਂ ਮਾਰਕਿਟ ਦੇ ਰੇਟ ਨਾਲੋਂ ਵੀ ਮਹਿੰਗੀਆਂ ਹਨ ਅਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਕਿਤਾਬਾਂ ਸ ਸਮੇਂ ਸਿਰ ਵੀ ਨਹੀਂ ਪਹੁੰਚੀਆਂ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਅੱਜ ਤੋਂ ਬਾਅਦ ਐਮਾਜ਼ੋਨ ਤੋਂ ਕੋਈ ਹੋਰ ਪ੍ਰੋਡਕਟ ਓਰਡਰ ਕਰਾਂਗਾ